ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਜੀ ਠੀਕ ਹੈ ਠੀਕ ਹੈ ਹੋਰ ਕੁਛ ਬਾਰਾਂ ਨੂੰ ਠੀਕ ਹੈ ਜੀ ਹੋਰ ਠੀਕ ਹੈ ਮੈਮ ਹੋਰ ਤਾਂ ਨਹੀਂ ਕੁਛ ਚਾਹੀਦਾ ਠੀਕ ਹੈ ਜੀ ਅੱਛਾ ਜੀ ਕਰ ਦਿੰਦੇ ਹਾਂ ਅੱਛਾ ਜੀ ਹਾਫ ਪਲੇਟ ਠੀਕ ਹੈ ਜੀ ਹੋਰ ਕੁਛ ਮੈਮ ਠੀਕ ਧੰਨਵਾਦ ਜੀ